ਖੇਡਾਂ ਨਾਲ ਸੰਬੰਧਿਤ ਹਿੰਸਾ ਦੇ ਮੁੱਦਿਆਂ ਨੂੰ ਰੋਕਣ ਲਈ ਖੇਡਾਂ ਪ੍ਰਬੰਧਕਾਂ ਦੁਆਰਾ ਬਹੁਤ ਜ਼ਿਆਦਾ ਕਾਨੂੰਨ ਲਾਗੂ ਕੀਤੇ ਜਾਂਦੇ ਹਨ ਜਿਵੇਂ ਕਿ ਖੇਡ ਦੇ ਮੈਦਾਨ ਦੇ ਬਾਹਰ ਇੱਕ ਮੈਟਲ ਡਿਟੈਕਟਰ ਲਗਾਇਆ ਜਾਂਦਾ ਹੈ ਜਿਸ ਨਾਲ ਜੇਕਰ ਕੋਈ ਵੀ ਆਦਮੀ ਹਥਿਆਰ ਲੈ ਕੇ ਮੈਦਾਨ ਦੇ ਅੰਦਰ ਜਾਵੇ ਤਾਂ ਉਸਦਾ ਪਤਾ ਲੱਗ ਜਾਵੇ ਇਸ ਦੇ ਨਾਲ ਹੀ ਗਰਾਊਂਡ ਦੇ ਬਾਹਰ ਹੀ ਇੱਕ ਐਂਬੂਲੈਂਸ ਖੜ੍ਹੀ ਕੀਤੀ ਜਾਂਦੀ ਹੈ ਤਾਂ ਕਿ ਜੇਕਰ ਕੋਈ ਵੀ ਦੁਰਘਟਨਾ ਵਾਪਰੀ ਅਤੇ ਕਿਸੇ ਵੀ ਖਿਡਾਰੀ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਪਹੁੰਚੇ ਤਾਂ ਉਸ ਮੌਕੇ 'ਤੇ ਹੀ ਉਸ ਨੂੰ ਉਸ ਦੀ ਜਾਨ ਬਚਾਈ ਜਾ ਸਕੇ ਅਤੇ ਇਸ ਦੇ ਨਾਲ ਹੀ ਜੇਕਰ ਕੋਈ ਆਦਮੀ ਕਿਸੇ ਵੀ ਖਿਡਾਰੀ ਉੱਤੇ ਹਮਲਾ ਕਰਦਾ ਹੈ ਤਾਂ ਉਸ ਸਮੇਂ ਕਾਨੂੰਨ ਲਾਗੂ ਕੀਤਾ ਗਿਆ ਹੈ ਕਿ ਉਸ ਟਾਈਮ 'ਤੇ ਹੀ ਪੁਲਿਸ ਆਉਂਦੀ ਹੈ ਅਤੇ ਉਸ ਆਦਮੀ ਉੱਪਰ ਕੋਈ ਕਾਰਵਾਈ ਕਰਦੀ ਹੈ ਜਿਸ ਕਰਕੇ ਉਹ ਅੱਗੇ ਤੋਂ ਇੱਕ ਅਜਿਹੀ ਗਲਤੀ ਨਾ ਕਰ ਸਕੇ ਇਸ ਦੇ ਨਾਲ ਛੋਟੀਆਂ ਗੇਮਾਂ ਵਿੱਚ ਵੀ ਅਤੇ ਨਾਲ ਹੀ ਇੱਕ ਫਸਟ ਏਡ ਬਾਕਸ ਰੱਖਿਆ ਜਾਂਦਾ ਹੈ ਜਿਸ ਨਾਲ ਮੌਕੇ 'ਤੇ ਹੀ ਉਸ ਖਿਡਾਰੀ ਦਾ ਇਲਾਜ ਕੀਤਾ ਜਾ ਸਕੇ ਧੰਨਵਾਦ